ਦੋ ਜਨਵਰੀ ਇੱਕ ਨੌਂ ਨੌਂ ਸੱਤ ਤਿੰਨ ਮਾਰਚ ਦੋ ਜ਼ੀਰੋ ਜ਼ੀਰੋ ਨੌਂ ਇੱਕ ਫਰਵਰੀ ਦੋ ਜ਼ੀਰੋ ਜ਼ੀਰੋ ਛੇ ਤਿੰਨ ਜਨਵਰੀ ਦੋ ਜ਼ੀਰੋ ਜ਼ੀਰੋ ਇੱਕ ਪੰਜ ਜੂਨ ਇੱਕ ਨੌਂ ਨੌਂ ਛੇ